ਜੀ ਹਾਂ ਮੈਂ ਸ਼ੇਅਰ ਮਾਰਕੀਟ ਬਾਰੇ ਥੋੜ੍ਹਾ ਬਹੁਤ ਜਾਣਦੀ ਹਾਂ ਜੇਕਰ ਅਸੀਂ ਸ਼ੇਅਰ ਮਾਰਕੀਟ ਵਿੱਚ ਉਤਰਾਅ ਚੜਾਅ ਦੀ ਗੱਲ ਕਰੀਏ ਤਾਂ ਇਹ ਸਭ ਕੁਝ ਵੱਡੇ ਲੋਕਾਂ ਦੇ ਹੱਥ ਵਿੱਚ ਹੈ ਜਾਂ ਵੱਡੀਆਂ ਕੰਪਨੀਆਂ ਦੇ ਪ੍ਰਮੋਟਰਸ ਦੇ ਹੱਥ ਵਿੱਚ ਹੈ ਉਹ ਹੀ ਬਾਜ਼ਾਰ ਦਾ ਭਾਅ ਤੈਅ ਕਰਦੇ ਹਨ ਅਤੇ ਜੇ ਉਹ ਚਾਹੁਣ ਤਾਂ ਬਾਜ਼ਾਰ ਨੂੰ ਸੁੱਟ ਸਕਦੇ ਹਨ ਜੇ ਉਹ ਚਾਹੁਣ ਤਾਂ ਬਾਜ਼ਾਰ ਨੂੰ ਚੜਾ ਵੀ ਸਕਦੇ ਹਨ ਇੱਕ ਆਮ ਬੰਦਾ ਇਸ ਬਾਰੇ ਕੀ ਸੋਚਦਾ ਵੀ ਨਹੀਂ ਹੈ ਜੇਕਰ ਅਸੀਂ ਮੌਜੂਦਾ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਇਸ ਵਕਤ ਇਲੈਕਸ਼ਨਸ ਦੇ ਕਰਕੇ ਹਰ ਇੱਕ ਕੰਪਨੀ ਦੇ ਸ਼ੇਅਰ ਬਹੁਤ ਤੇਜ਼ੀ ਨਾਲ ਉੱਪਰ ਚੜ ਰਹੇ ਹਨ ਕਿਉਂਕਿ ਹਰ ਇੱਕ ਸੈਕਟਰ ਦੀ ਕੰਪਨੀ ਨੂੰ ਲੱਗਦਾ ਹੈ ਕਿ ਮੌਜੂਦਾ ਸਰਕਾਰ ਨਵੇਂ ਬਜਟ ਵਿੱਚ ਕੁਛ ਨਾ ਕੁਛ ਨਵੀਆਂ ਚੀਜ਼ਾਂ ਲੈ ਕੇ ਆਵੇਗੀ ਇਸ ਕਰਕੇ ਅੱਜ ਕੱਲ੍ਹ ਸ਼ੇਅਰ ਬਾਜ਼ਾਰ ਇੱਕ ਸਮਾਨ ਸਪੀਡ ਨਾਲ ਦੌੜ ਰਹੇ ਹਨ ਇਹ ਤਾਂ ਖੋਤਾ ਘੋੜਾ ਇੱਕ ਸਮਾਨ ਵਾਲੀ ਗੱਲ ਹੈ ਪਰ ਅਸਲੀ ਘੋੜੇ ਦੀ ਸਪੀਡ ਵਾਲੇ ਸ਼ੇਅਰਾਂ ਦਾ ਪਤਾ ਸਾਨੂੰ ਚੋਣਾਂ ਤੋਂ ਬਾਅਦ ਲੱਗੇਗਾ ਅਗਰ ਅਸੀਂ ਡਿਜੀਟਲ ਐਪਸ ਦੀ ਗੱਲ ਕਰੀਏ ਤਾਂ ਇਹਨਾਂ ਨੇ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਦੇ ਮੁਕਾਬਲੇ ਬਹੁਤ ਆਸਾਨੀ ਕਰ ਦਿੱਤੀ ਹੈ ਇਹਨਾਂ ਐਪਸ ਦੇ ਨਾਲ ਆਮ ਲੋਕਾਂ ਦੀ ਪਹੁੰਚ ਤੱਕ ਸ਼ੇਅਰ ਬਾਜ਼ਾਰ ਹੈ ਹੁਣ ਸ਼ੇਅਰ ਮਾਰਕਿਟ ਵਿੱਚ ਇੰਟਰਸਟ ਰੱਖਣ ਵਾਲੇ ਲੋਕ ਇਸ ਬਾਰੇ ਕ ਹਰ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਪਣੇ ਆਪ ਨਿਵੇਸ਼ ਕਰ ਰਹੇ ਹਨ ਪਹਿਲਾਂ ਦੇ ਮੁਕਾਬਲੇ ਬਹੁਤ ਸੌਖੇ ਤਰੀਕੇ ਨਾਲ ਪੈਸਾ ਲਗਾ ਸਕਦੇ ਹਨ ਅਤੇ ਬਹੁਤ ਹੀ ਸੌਖੇ ਤਰੀਕੇ ਨਾਲ ਸ਼ੇਅਰ ਵੇਚ ਕੇ ਆਪਣੇ ਆਪ ਪੈਸਾ ਕਢਵਾ ਸਕਦੇ ਹਨ ਇਸ ਨਾਲ ਸਾਡੇ ਟਾਈਮ ਦੀ ਵੀ ਬੱਚਤ ਹੁੰਦੀ ਹੈ ਸ਼ੇਅਰ ਮਾਰਕੀਟਸ ਅਗਰ ਸਾਨੂੰ ਪੈਸਾ ਬਣਾ ਕੇ ਦਿੰਦੀ ਹੈ ਅਤੇ ਜੇਕਰ ਅਸੀਂ ਸਹੀ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਈਏ ਤਾਂ ਅਣਗਿਣਤ ਸ਼ਹਿਰ ਲ ਸ਼ੇਅਰ ਲੈ ਲਵਾਂਗੇ ਤਾਂ ਇਹ ਬਹੁਤ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਹਰ ਇੱਕ ਡਿਜ ਡਿਜ਼ੀਟਲ ਐਪ ਦੇ ਆਪਣੇ ਵੱਖਰੇ ਵੱਖਰੇ ਰੂਲ ਅ ਟਰਮ ਅਤੇ ਕੰਡੀਸ਼ਨਸ ਹੁੰਦੀਆਂ ਹਨ ਇਸ ਵਾਸਤੇ ਸ਼ੇਅਰ ਬਾਜ਼ਾਰ ਵਿੱਚ ਇਹਨਾਂ ਡਿਜੀਟਲ ਐਪਸ ਦੇ ਸਹਾਰੇ ਪੈਸਾ ਲਗਾਉਣਾ ਖ਼ਤਰਨਾਕ ਹੋ ਸਕਦਾ ਹੈ